ਪਿੰਜਰੇ ਵਿੱਚ ਕੈਦ ਪੰਛੀਆਂ ਨੂੰ ਦੇਖ ਕੇ ਸਾਡੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਸਾਨੂੰ ਇਹਨਾਂ ਨੂੰ ਕੈਦ ਕੈਦ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਸਭ ਨੂੰ ਆਜ਼ਾਦੀ ਦਿੱਤੀ ਹੈ ਸਾਨੂੰ ਇਹਨਾਂ ਨੂੰ ਕੈਦ ਨਹੀਂ ਕਰਨਾ ਚਾਹੀਦਾ ਕਿ ਹੋ ਕੇ ਪੰਛੀ ਉੜ ਨਹੀਂ ਸਕਦਾ ਅਤੇ ਨਾ ਹੀ ਉਸਨੂੰ ਆਪਣੀ ਅਸਲੀ ਪਹਿਚਾਣ ਹੋ ਸਕਦੀ ਹੈ ਇਹ ਆਪਣੀ ਅਸਲੀ ਅਸਲੀ ਕੰਮ ਅਤੇ ਸ਼ਕਤੀ ਸ਼ਕਤੀ ਨੂੰ ਨਹੀਂ ਮਾਪ ਸਕਦਾ ਪਿੰਜਰੇ ਵਿੱਚ ਕੋਈ ਪੰਛੀ ਕਦੇ ਵੀ ਖੁਸ਼ ਖੁਸ਼ ਖੁਦ ਤੋਂ ਨਿਰਭਰ ਨਹੀਂ ਹੋ ਸਕਦਾ ਮੇਰੇ ਅਨੁਸਾਰ ਹਰ ਪੰਛੀ ਨੂੰ ਆਜ਼ਾਦ ਹੋਣਾ ਚਾਹੀਦਾ ਹੈ ਮੈਂ ਇੱਕ ਵਾਰ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਚਿੜੀਆਂ ਉੜਾਉਣ ਉਹਨਾਂ ਦੇ ਚ ਪਿੰ ਦੇ ਪਿੰਜਰੇ ਤੋਂ ਆਜ਼ਾਦ ਕੀਤਾ ਸੀ